ਅਸੀਂ ਅਤੇ ਸਾਡਾ ਪਰਿਵਾਰ ਧਾਰਮਿਕ ਤਿਉਹਾਰ ਨੂੰ ਮਨਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੱਥਾ ਟੇਕਦੇ ਹਾਂ ਸੇਵਾ ਕਰਕੇ ਅਸੀਂ ਵਾਪਿਸ ਘਰ ਆਉਂਦੇ ਹਾਂ ਅਤੇ ਬਾਕੀ ਅਸੀਂ ਘਰ ਵਿੱਚ ਵੀ ਤਿਆਰੀਆਂ ਕਰਦੇ ਹਾਂ ਘਰ ਨੂੰ ਸਾ ਸਫ਼ਾਈ ਕਰਦੇ ਹਾਂ ਵੱਡੀ ਸਫ਼ਾਈ ਜਿਹਨੂੰ ਕਹਿੰਦੇ ਆ ਅਤੇ ਸਜਾਵਟ ਵਾਸਤੇ ਅਸੀਂ ਬਲਬਾਂ ਵਾਲੀਆਂ ਲੜੀਆਂ ਲਾਉਂਦੇ ਹਾਂ ਲਾਈਟਾਂ ਵਾਲੀਆਂ ਫਿਰ ਅਸੀਂ ਮੋਮਬੱਤੀਆਂ ਜਗਾਉਦੇ ਹਾਂ ਦੀਵੇ ਵਿੱਚ ਤੇਲ ਪਾ ਕੇ ਅਤੇ ਉਹਨਾਂ ਨੂੰ ਵੀ ਬਾਲਦੇ ਹਾਂ ਅੱਗੇ ਖਾਣ ਵਾਸਤੇ ਅਸੀਂ ਉਸ ਦਿਨ ਮਠਿਆਈਆਂ ਬਣਾ ਲੈਂਦੇ ਹਾਂ ਜਿੱਦਾਂ ਸੇਵੀਆਂ ਹੋ ਗਈਆਂ ਅਤੇ ਬਾਕੀ ਮਿੱਠੇ ਚੌਲ ਹੋ ਜਾਂਦੇ ਉਹ ਖਾਈ ਦੇ ਆ ਬਣਾ ਲਈ ਦੇ ਆ ਅਤੇ ਹੋਰ ਵਧੀਆ ਸਬਜ਼ੀਆਂ ਪਨੀਰ ਵਗੈਰਾ ਵੀ ਬਣਾਇਆ ਜਾਂਦਾ ਵਾ ਬਾ ਅਤੇ ਸਜਾਵਟ ਕਰਕੇ ਅਸੀਂ ਆਪਣੀ ਆਤਿਸ਼ਬਾਜੀ ਵੀ ਚਲਾਉਦੇ ਹਾਂ